ਮੈਨੂੰ ਕ੍ਰਿਕਟ ਖੇਡਣਾ ਬਹੁਤ ਹੀ ਚੰਗਾ ਲੱਗਦਾ ਸੀ ਮੇਰੀ ਇਹ ਮਨਪਸੰਦ ਗੇਮ ਸੀ ਪਰ ਜੋ ਇਸ ਦਾ ਸਮਾਨ ਬਜ਼ਾਰ ਵਿੱਚ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਸੀ ਇਸ ਦੀ ਕਿੱਟ ਵਿੱਚ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੈ ਜਿਵੇਂ ਕਿ ਬੈਟ ਵਿਕਟਾਂ ਪੈਡਸ ਇਹ ਬਹੁਤ ਹੀ ਮਹਿੰਗੀਆਂ ਨੇ ਬਜ਼ਾਰ ਦੇ ਵਿੱਚ ਪੈਸੇ ਦੀ ਕਮੀ ਕਰਕੇ ਮੈਂ ਇਹ ਚੀਜ਼ਾਂ ਬਜ਼ਾਰੋਂ ਨਹੀਂ ਖਰੀਦ ਸਕਦਾ ਸੀ ਇਸ ਲਈ ਮੈਂ ਘਰੇ ਹੀ ਲੱਕੜੀ ਦਾ ਪ੍ਰਬੰਧ ਕੀਤਾ ਉਸ ਦੇ ਥਰੂ ਮੈਂ ਆਪਣੀਆਂ ਵਿਕਟਾਂ ਬਣਾਈਆਂ ਬੈਟ ਬਣਾਇਆ ਆਰੇ ਉੱਤੇ ਜਾ ਕੇ ਉਸ ਦੀ ਚੰਗੀ ਤਰ੍ਹਾਂ ਸੈਟਿੰਗ ਕਰਵਾਈ